ਹੈਲੋ ਹਾਂਜੀ ਦਰਪਨਪ੍ਰੀਤ ਬੋਲ ਰਿਹਾਂ ਜੀ ਐਡਵੋਕੇਟ ਪਟਿਆਲੇ ਤੋਂ ਅੱਛਾ ਜੀ ਹਾਂਜੀ ਹਾਂਜੀ ਮੈਨੂੰ ਕੱਲ੍ਹ ਹੀ ਕੌਲ ਆਈ ਸੀਗੀ ਤੁਹਾਡੇ ਬਾਰੇ ਦੱਸਿਆ ਸੀਗਾ ਉਹਨਾਂ ਨੇ ਹਾਂਜੀ ਕੋਈ ਫਰੋਡ ਦਾ ਕੇਸ ਹੈ ਤੁਹਾਡਾ ਕੀ ਚੱਕਰ ਹੋਇਆ ਜੀ ਓਕੇ ਅੱਛਾ ਜੀ ਹਾਂਜੀ ਅਤੇ ਕਿਵੇਂ ਤੁਹਾਡੇ ਕੋਲ ਮਤਲਬ ਸਾਰੇ ਪਰੂਫ਼ ਵਗੈਰਾ ਹੈਗੇ ਨੇ ਜੋ ਵੀ ਤੁਸੀਂ ਦਿੱਤਾ ਸੀਗਾ ਉਹਨਾਂ ਨੂੰ ਉਹਨਾਂ ਦੀ ਰਿਸਿਪਟ ਵਗੈਰਾ ਬੈਂਕ ਸਟੇਟਸਮੈਂਟ ਸਟੇਟਮੈਂਟ ਵਗੈਰਾ ਅੱਛਾ ਜੀ ਚਲੋ ਤੁਸੀਂ ਮੇਰੇ ਕੋਲ ਕੱਲ੍ਹ ਆ ਜਿਓ ਔਫਿਸ 'ਚ ਮੇਰੇ ਆ ਜਿਓ ਸਾਰੀ ਡਿਟੇਲਸ ਲੈ ਕੇ ਸਾਰੇ ਪਰੂਫ਼ਸ ਲੈ ਕੇ ਅਤੇ ਆਹ ਸਟਾਮ ਪੇਪਰ ਵੀ ਜਿਹੜਾ ਕਹਿ ਰਹੇ ਹੋ ਆਪਣੇ ਨਾਲ਼ ਲੈ ਕੇ ਆਇਓ ਆਪਾਂ ਔਫਿਸ 'ਚ ਬੈਠ ਕੇ ਇਸ ਬਾਰੇ ਸਾਰੀ ਡਿਟੇਲ ਵਿੱਚ ਗੱਲ ਕਰ ਲਾਂਗੇ ਅਤੇ ਆਪਾਂ ਕਰ ਦਿੰਦੇ ਹਾਂ ਤੁਹਾਡਾ ਕੇਸ ਫਾਈਲ ਓਕੇ ਜੀ ਮਾ